ਹਾਂਜੀ ਜੀ ਹਾਂਜੀ ਜੀ ਕੀ ਹਾਲ ਜੀ ਠੀਕ ਹੋ ਹਾਂਜੀ ਹਾਂਜੀ ਬੋਲੋ ਜੀ ਜੀ ਜੀ ਜੀ ਓਕੇ ਠੀਕ ਆ ਜੀ ਠੀਕ ਆ ਹੂੰ ਦੇਖੋ ਜੀ ਮੈਂ ਜੀ ਜੀ ਜੀ ਜੀ ਜੀ ਜੀ ਮਿਲਾਵਟ ਠੀਕ ਹੈ ਜੀ ਹੂੰ ਦੇਖੋ ਜੀ ਸੂਰਜ ਜੀ ਮੈਂ ਪਿਛਲੇ ਲਗਭਗ ਤੀਹ ਸਾਲਾਂ ਤੋਂ ਇੱਥੇ ਗੁਰਦਾਸਪੁਰ 'ਚ ਰਹਿ ਰਿਹਾ ਔਰ ਮੈਂ ਜਨਮ ਤੋਂ ਹੀ ਇੱਥੇ ਰਹਿ ਰਿਹਾ ਜਿੰਨਾ ਕੁ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਵਾਚਿਆ ਕਿ ਜਿਹੜੇ ਸਾਡੇ ਗੁਰਦਾਸਪੁਰ ਦੇ ਕੁਝ ਤਿੰਨ ਚਾਰ ਐਸੀਆ ਚੁਨਿੰਦਾ ਡੇਅਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਅੱਛਾ ਦੁੱਧ ਔਰ ਅੱਛੀ ਕੁਆਲਟੀ ਦਾ ਦੁੱਧ ਮਿਲਦਾ ਜਿੰਨ੍ਹਾਂ ਵਿੱਚੋਂ ਬਸੰਤ ਦੀ ਡੇਅਰੀ ਜਿਹੜੀ ਹਨੁਮਾਨ ਚੌਂਕ 'ਚ ਆ ਏ ਐਸ ਡੇਅਰੀ ਜਿਹੜੀ ਆ ਉਹ ਗੌਰਮੈਂਟ ਕਾਲਜ ਹਾਂ ਏ ਐਸ ਡੇਅਰੀ ਜਿਹੜੀ ਆ ਕਿ ਗਵਰਨਮੈਂਟ ਕਾਲਜ ਰੋਡ 'ਤੇ ਆ ਇਹਨਾਂ ਡੇਅਰੀਆਂ ਦਾ ਦੁੱਧ ਦਈ ਸਾਰਾ ਓਰਿਜਨਲ ਹੁੰਦਾ ਔਰ ਵਧੀਆ ਰੇਟ 'ਤੇ ਮਿਲਦਾ ਜੀ ਨਾ ਜੀ ਸੂਰਜ ਜੀ ਇਹਨਾਂ ਦਾ ਰੇਟ ਵੀ ਜੈਨੁਅਲ ਆ ਕੋਈ ਇੰਨੇ ਰੇਟ ਨਹੀਂ ਮੈਨੂੰ ਲੱਗਦਾ ਜਿਹੜਾ ਮੱਝ ਦਾ ਦੁੱਧ ਹੈ ਉਹ ਸੱਠ ਰੁਪਈਏ ਔਰ ਗਾਂ ਦਾ ਦੁੱਧ ਉਹ ਪਚਵੰਜਾ ਕੁ ਰੁਪਈਆਂ ਦਾ ਮਿਲ ਜਾਂਦਾ ਹੈ ਇਹਦੇ ਏਡ ਗੇੜ ਨਹੀਂ ਮੈਂ ਇਹ ਹੀ ਤੁਹਾਨੂੰ ਕਹਿਣਾ ਚਾਹਵਾਂਗਾ ਵੀ ਇਹ ਜਿਹੜੀਆਂ ਦੋ ਡੇਅਰੀਆਂ ਨਾ ਤੁਸੀਂ ਇਹਨਾਂ ਦੋਹਾਂ ਡੇਅਰੀਆਂ ਦਾ ਜਿਹੜਾ ਵਾ ਦੁੱਧ ਜਿਹੜਾ ਵਾ ਉਹ ਵਰਤ ਕੇ ਇੱਕ ਵਾਰ ਵੇਖੋ ਤੇ ਤੁਹਾਨੂੰ ਤੁਸੀਂ ਇੱਕ ਵਾਰ ਵਰਤੋਗੇ ਤਾਂ ਤੁਹਾਨੂੰ ਮਤਲਬ ਅੱਛੇ ਰਿਜਲਟ ਮਿਲਣਗੇ ਉਹ ਫਿਰ ਤੁਸੀਂ ਇੱਥੋਂ ਦੁਬਾਰਾ ਲਿਆ ਕਰੋਗੇ ਹਾਂਜੀ ਹਾਂਜੀ ਸ਼ੈਲੀ ਡੇਅਰੀ ਸ਼ੈਲੀ ਡੇਅਰੀ ਵੀ ਦੇਖੋ ਜੀ ਉਹਨਾਂ ਦਾ ਰੇਟ ਥੋੜ੍ਹਾ ਜ਼ਿਆਦਾ ਆ ਲੇਕਿਨ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਇੰਨੀ ਸਹੀ ਨਹੀਂ ਹੈਗੀ ਜੀ ਸ਼ੈਲੀ ਡੇਅਰੀ ਦਾ ਰੇਟ ਸੱਤਰ ਰੁਪਈਏ ਦਿੰਦੇ ਮੱਝ ਦਾ ਦੁੱਧ ਲੇਕਿਨ ਉਹ ਮੈਨੂੰ ਲੱਗਦਾ ਨਹੀਂ ਵੀ ਇੰਨਾ ਸਹੀ ਦੁੱਧ ਉਹ ਦਿੰਦੇ ਆ ਸ਼ੈਲੀ ਡੇਅਰੀ ਹਾਂ ਉਹਨਾਂ ਦਾ ਘਿਓ ਠੀਕ ਹੁੰਦਾ ਘਿਓ ਦਾ ਰੇਟ ਛੇ ਸੌ ਰੁਪਈਏ ਸ਼ਾਇਦ ਕਿਲੋ ਆ ਘਿਓ ਠੀਕ ਹੁੰਦਾ ਜੀ ਉਹਨਾਂ ਦਾ ਨਹੀਂ ਜੀ ਇਸ ਤੋਂ ਇਲਾਵਾ ਤਾਂ ਮੇਰੇ ਧਿਆਨ 'ਚ ਹੈ ਨਹੀਂ ਹੈ ਜੀ ਕੋਈ ਸਰ ਉਹਨਾਂ ਉਹਦਾ ਨਹੀਂ ਮੈਨੂੰ ਪਤਾ ਸਰ ਹਾਲੇ ਡੇਅਰੀ ਦਾ ਨਹੀਂ ਮੈਨੂੰ ਪਤਾ ਜੇ ਮੈਂ ਐਵੇਂ ਤੁਹਾਨੂੰ ਕਹਾਂ ਠੀਕ ਹੈ ਸੂਰਜ ਜੀ ਓਕੇ ਜੀ ਧੰਨਵਾਦ